ਮੈਂ ਆਪਣੀ ਭੰਗੜਾ ਕਲਾਸ ਵਿੱਚ ਜਦੋਂ ਪਹਿਲੀ ਵਾਰੀ ਗਿਆ ਸੀ ਤਾਂ ਉਹਨਾਂ ਨੇ ਮੈਨੂੰ ਭੰਗੜੇ ਦੇ ਕੁਛ ਰੂਲਸ ਦੱਸੇ ਕੁਝ ਨਿਯਮ ਦੱਸੇ ਜਿੰਨਾਂ ਵਿੱਚ ਇੱਕ ਤਾਂ ਇਹ ਕਿ ਭੰਗੜਾ ਸਿਰ ਢੱਕ ਕੇ ਪਾਉਣਾ ਹੈ ਦੂਸਰਾ ਭੰਗੜਾ ਪਾਣ ਲੱਗਿਆ ਪੈਰਾਂ ਵਿੱਚ ਜੁੱਤੀ ਨਹੀਂ ਹੋਣੀ ਚਾਹੀਦੀ ਅਤੇ ਭੰਗੜੇ ਦੇ ਵਿੱਚ ਤੁਸੀਂ ਸਾਰਿਆਂ ਨਾਲ ਮਿਲ ਕੇ ਜਿਹੜੇ ਸਟੈਪ ਕਰਨੇ ਹਨ ਅਤੇ ਭੰਗੜੇ ਦੇ ਵਿੱਚ ਸਾਰੇ ਆਪਾਂ ਮਿਲ ਕੇ ਜਦੋਂ ਭੰਗੜਾ ਪਾ ਰਹੇ ਸੀ ਤਾਂ ਮੈਨੂੰ ਬਹੁਤ ਮਜ਼ਾ ਆ ਰਿਹਾ ਸੀ ਕਿਉਂਕਿ ਉਸ ਵਿੱਚ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਸੀ ਅਤੇ ਮੈਨੂੰ ਲੱਗ ਰਿਹਾ ਸੀ ਸਾਰੇ ਮੇਰੇ ਨਾਲ ਜਿਹੜੇ ਭੰਗੜਾ ਪਾ ਰਹੇ ਹਨ ਉਹ ਮੇਰੇ ਪੱਕੇ ਸਾਥੀ ਹਨ ਅਤੇ ਸਾਡਾ ਆਪਸ ਦੇ ਵਿੱਚ ਵੀ ਬਹੁਤ ਪਿਆਰ ਹੋ ਗਿਆ ਸੀ ਔਰ ਇਸ ਤਰ੍ਹਾਂ ਨਾਲ ਅਸੀਂ ਭੰਗੜੇ ਦੀ ਕਲਾਸ ਵਿੱਚ ਬਹੁਤ ਖੁਸ਼ੀ ਮਹਿਸੂਸ ਕਰਦੇ ਅਤੇ ਆਪਣਾ ਦਿਨ ਉਡੀਕਦੇ ਕਦੋਂ ਉਹ ਟਾਈਮ ਆਵੇ ਅਤੇ ਅਸੀਂ ਭੰਗੜੇ ਕਲਾਸ ਦੇ ਵਿੱਚ ਜਾ ਕੇ ਭੰਗੜਾ ਪਾਈਏ ਅਤੇ ਇੱਕ ਦੂਜੇ ਨੂੰ ਮਿਲੀਏ ਕਿਉਂਕਿ ਭੰਗੜਾ ਕਰਨ ਦੇ ਨਾਲ ਐ ਲੱਗਦਾ ਸੀ ਕਿ ਸਾਨੂੰ ਕੋਈ ਚਿੰਤਾ ਨਹੀਂ ਹੈ ਅਤੇ ਖੁਸ਼ੀ ਖੁਸ਼ੀ ਅਸੀਂ ਭੰਗੜੇ ਦੀ ਆਰੋਬਿਕਸ ਕਲਾਸ ਦੇ ਵਿੱਚ ਇੱਕ ਦੂਜੇ ਨੂੰ ਮਿਲਦੇ ਅਤੇ ਬੜੇ ਉਤਸਾਹਿਤ ਰਸਤੇ ਦੇ ਨਾਲ ਇੱਕ ਦੂਜੇ ਨੂੰ ਮਿਲ ਕੇ ਭੰਗੜਾ ਪਾਂਦੇ ਅਤੇ ਭੰਗੜੇ ਵਿੱਚ ਇੱਕ ਦੂਜੇ ਨੂੰ ਸਾਰਾ ਕੁਝ ਸਿਖਾਂਦੇ ਜੇ ਕਿਸੇ ਕੋਲ ਕੋਈ ਗਲਤੀ ਹੋ ਜਾਵੇ ਤਾਂ ਉਹਨੂੰ ਠੀਕ ਵੀ ਕਰਦੇ ਸਾਨੂੰ ਬਹੁਤ ਮਜ਼ਾ ਆਉਂਦਾ ਸੀ